ਹੈਲੋ ਹਾਂਜੀ ਹਾਂਜੀ ਕੀ ਹਾਲ ਹੈ ਜਨਾਬ ਵਧੀਆ ਜੀ ਠੀਕ ਠਾਕ ਆਪਣੇ ਸੁਣਾਓ ਕੀ ਬਣ ਰਿਹਾ ਅੱਛਾ ਬਠਿੰਡੇ ਆ ਗਏ ਵੈਰੀ ਗੁੱਡ ਸਹੀ ਆ ਜੀ ਸਹੀ ਆ ਹਾਂਜੀ ਹਾਂਜੀ ਆਪਾਂ ਨੂੰ ਤਾਂ ਪੰਦਰਾਂ ਸਾਲ ਹੋ ਗਏ ਘੱਟੋ ਘੱਟ ਬਠਿੰਡੇ ਰਹਿੰਦਿਆਂ ਤੁਸੀਂ ਕਦੋਂ ਸਿਫਟ ਕੀਤਾ ਅੱਛਾ ਜੋਬ ਦੇ ਟਰਾਂਸਫਰ ਹੋ ਗਈ ਬਹੁਤ ਵਧੀਆ ਬਹੁਤ ਬਹੁਤ ਮੁਬਾਰਕਾਂ ਹਾਂਜੀ ਹਾਂਜੀ ਘੁੰਮਣ ਨੂੰ ਹਾਂਜੀ ਹਾਂਜੀ ਘੁੰਮਣ ਵ ਲਈ ਵਧੀਆ ਹੈ ਬਠਿੰਡੇ ਸ਼ਹਿਰ ਵਿੱਚ ਬਹੁਤ ਅੱਛੀਆਂ ਜਗ੍ਹਾਵਾਂ ਹਨ ਘੁੰਮਣ ਲਈ ਜਿਵੇਂ ਕਿ ਸਭ ਤੋਂ ਪਹਿਲਾਂ ਤਾਂ ਹੁਣ ਇੱਕ ਨਵਾਂ ਆਪਣੇ ਇੱਥੇ ਖੁੱਲਿਆ ਵਾਟਰ ਪਾਰਕ ਪਨਫਨ ਹੈ ਨਾ ਉਹ ਵੀ ਬਹੁਤ ਅੱਛੀ ਚੀਜ਼ ਹੈ ਮਤਲਬ ਆਪਣੇ ਏਰੀਏ ਦੇ ਲਗਭਗ ਸਭ ਤੋਂ ਵੱਡਾ ਵਾਟਰ ਪਾਰਕ ਹੈ ਅਤੇ ਲਗਭਗ ਫੀਸ ਪਰ ਪਰਸਨ ਹੈਗੀ ਹੈ ਪੰਦਰਾਂ ਸੌ ਰੁਪਈਆ ਉਹਦੇ ਵਿੱਚ ਹੀ ਜੋ ਹੈ ਲੰਚ ਵਗੈਰਾ ਵੀ ਦਿੰਦੇ ਆ ਤਾਂ ਬਹੁਤ ਅੱਛਾ ਹੈ ਅਤੇ ਬੱਚਿਆਂ ਲਈ ਵੀ ਅੱਛਾ ਹੈ ਉਸ ਤੋਂ ਇਲਾਵਾ ਆਪਣੇ ਕੋਲ ਜਗ੍ਹਾ ਆ ਜਾਂਦੀ ਹੈ ਮੁਬਾਰਕ ਸਾਹਿਬ ਗੁਰਦੁਆਰਾ ਕਿਲ੍ਹਾ ਸਾਹਿਬ ਹੈ ਨਾ ਉਹ ਵੀ ਠੀਕ ਹੈ ਮਿੱਤਲ ਮੋਲ ਹੈ ਹੈ ਨਾ ਚੇਤਕ ਪਾਰਕ ਹੈ ਘੁੰਮਣ ਲਈ ਬਹੁਤ ਵਧੀਆ ਜਗ੍ਹਾ ਨੇ ਹੂੰ ਹਾਂ ਵੈਸੇ ਤਾਂ ਇਤਿਹਾਸਿਕ ਗੁਰਦੁਆਰਾ ਆਪਣੇ ਇੱਕ ਹੀ ਹੈ ਆਪਣੇ ਬਠਿੰਡੇ ਮੁਬਾਰਕ ਹੈ ਨਾ ਕਿਲ੍ਹਾ ਮੁਬਾਰਕ ਗੁਰਦੁਆਰਾ ਸਾਹਿਬ ਉੱਥੇ ਹਾਂ ਉਹ ਜਗ੍ਹਾ ਅੱਛੀ ਹੈ ਘੁੰਮਣ ਲਈ ਹਾਂ ਉਸ ਤੋਂ ਬਾਅਦ ਵੈਸੇ ਬੱਚਿਆਂ ਨੂੰ ਜ਼ਿਆਦਾ ਸ਼ੌਂਕ ਜਿਹੜਾ ਹੁੰਦਾ ਉਹ ਵਾਟਰ ਪਾਰਕ ਦਾ ਹੁੰਦਾ ਵੈਸੇ ਵੀ ਨਿਊਲੀ ਓਪਨ ਹੈ ਉਹ ਅਤੇ ਉਹ ਮੇਰੇ ਹਿਸਾਬ ਨਾਲ ਬੱਚਿਆਂ ਲਈ ਬੈਟਰ ਹੈ ਟਾਈਮਿੰਗ ਬਸ ਸੁਬਹ ਤੋਂ ਸ਼ੁਰੂ ਹੋ ਜਾਂਦੀ ਹੈ ਅਤੇ ਸ਼ਾਮ ਰਾਤ ਤੱਕ ਚਲਦੀ ਹੈ ਜੀ ਹਾਂ ਉੱਧਰ ਵੈਸੇ ਮਿੰਨੀ ਬੱਸ ਸਰਵਿਸ ਵੀ ਹੈ ਅਤੇ ਉਸ ਤੋਂ ਇਲਾਵਾ ਆਟੋ ਵਗੈਰਾ ਵੀ ਚੱਲਦੇ ਆ ਇੱਧਰ ਹੈ ਨਾ ਅਤੇ ਜੇ ਪਰਸਨਲ ਵਹੀਕਲ ਹੈ ਤਾਂ ਉਹਦੇ ਵਰਗੀ ਤਾਂ ਰੀਸ ਕੋਈ ਨਹੀਂ ਪਾਰਕਿੰਗ ਫੀਸ ਵੀ ਹਾਂ ਪਾਰਕਿੰਗ ਫੀਸ ਵੀ ਉਹਨਾਂ ਦੀ ਅਲੱਗ ਤੋਂ ਹੁੰਦੀ ਆ ਹੈ ਨਾ ਹਾਂ ਬਹੁਤ ਵਧੀਆ ਜਗ੍ਹਾ ਹੈ ਘੁੰਮਣ ਲਈ ਕੋਈ ਗੱਲ ਨਹੀਂ ਬਾਕੀ ਮਿਲੋ ਫੈਮਲੀ ਮੈਂਬਰਜ ਨੂੰ ਲੈ ਕੇ ਆਓ ਮਿਲਦੇ ਹਾਂ ਆਪਾਂ ਬੱਚਿਆਂ ਨੂੰ ਲੈ ਕੇ ਆਓ ਹਾਂਜੀ ਹਾਂਜੀ ਜ਼ਰੂਰ ਠੀਕ ਹੈ ਜੀ